ਹੈਲੋ ਕੀ ਤੁਸੀਂ ਜੀਐਸਟੀ ਰਜਿਸਟਰੇਸ਼ਨ ਦਫਤਰ ਤੋਂ ਬੋਲ ਰਹੇ ਹੋ ਮੈਂ ਤੁਹਾਡੇ ਕੋਲ ਜੀਐਸਟੀ ਰਜਿਸਟਰੇਸ਼ਨ ਦੀਆਂ ਸਪਸ਼ਟੀਕਰਨ ਵਾਸਤੇ ਜ਼ਰੂਰੀ ਸ਼ਰਤਾਂ ਬਾਰੇ ਜਾਣਨਾ ਚਾਹੁੰਦੀ ਹਾਂ ਕਿਉਂਕਿ ਮੈਂ ਇੱਕ ਘਰੇਲੂ ਬੇਕਰੀ ਚਲਾਉਣਾ ਚਾਹੁੰਦੀ ਹਾਂ ਅਤੇ ਜਾਣਨਾ ਚਾਹੁੰਦੀ ਹਾਂ ਕਿ ਮੇਰੇ ਕਾਰੋਬਾਰ ਦੇ ਲਈ ਜੀਐਸਟੀ ਰਜਿਸਟਰੇਸ਼ਨ ਜ਼ਰੂਰੀ ਕਿਉਂ ਹੈ ਅਤੇ ਇਹਦੇ ਮੈਨੂੰ ਕੀ ਫਾਇਦੇ ਹੋਣਗੇ ਮੇਰੀਆਂ ਜਿਹੜੀਆਂ ਵੀ ਵਪਾਰਕ ਗਤੀਵਿਧੀਆਂ ਨੇ ਫਿਲਹਾਲ ਮੇਰੇ ਸ਼ਹਿਰ ਵਿੱਚ ਹੀ ਚੱਲ ਰਹੀਆਂ ਹਨ ਅਤੇ ਮੈਂ ਬਾਹਰ ਵੀ ਇਹ ਕੰਮ ਨੂੰ ਵਧਾਉਣਾ ਚਾਹੁੰਦੀ ਹਾਂ ਇਸ ਕਰਕੇ ਮੇਰੀ ਮਦਦ ਕੀਤੀ ਜਾਵੇ ਜਾਂ ਮੈਨੂੰ ਕੋਈ ਅਜਿਹੀ ਤੁਹਾਡੀ ਵੈਬਸਾਈਟ ਦਾ ਪਤਾ ਲੱਗ ਜਾਵੇ ਜਿਹਦੇ ਰਾਹੀਂ ਮੈਂ ਇਸ ਰਜਿਸਟ੍ਰੇਸ਼ਨ ਨੂੰ ਅਪਲਾਈ ਕਰ ਸਕਾਂ ਨਹੀਂ ਤਾਂ ਲਿਖਤੀ ਰੂਪ ਦੇ ਵਿੱਚ ਜੇ ਕੋਈ ਅਰਜੀ ਦੇਣੀ ਹੈ ਇਸ ਦਫਤਰ ਵਿੱਚ ਤਾਂ ਉਹ ਫਾਰਮ ਮੈਨੂੰ ਕਿੱਥੋਂ ਮਿਲੇਗਾ